ਬਾਰ੍ਹਾਂ ਗਿਆਰ੍ਹਾਂ ਦੋ ਹਜ਼ਾਰ ਬਾਈ ਚੌਦ੍ਹਾਂ ਦਸ ਉੱਨੀ ਸੌ ਚੁਰਾਨਵੇਂ ਨੌ ਚਾਰ ਉੱਨੀ ਸੌ ਤਿਹੱਤਰ ਤੇਈ ਗਿਆਰ੍ਹਾਂ ਦੋ ਹਜ਼ਾਰ ਤੇਈ ਸੱਤ ਅੱਠ ਦੋ ਹਜ਼ਾਰ ਚੌਦ੍ਹਾਂ